ਅੱਜ ਕੱਲ੍ਹ ਬਹੁਤ ਸਾਰੇ ਲੋਕ ਲਿਖਣਾ ਬਹੁਤਾ ਪਸੰਦ ਨਹੀਂ ਕਰਦੇ ਬੱਟ ਲੇਕਿਨ ਮੈਨੂੰ ਲਿਖਣਾ ਬਹੁਤ ਪਸੰਦ ਹੈ ਕਿਉਂਕਿ ਲਿਖਣ ਦੇ ਨਾਲ ਜੋ ਭਾਵ ਤੁਸੀਂ ਪ੍ਰਗਟ ਕਰ ਸਕਦੇ ਹੋ ਉਹ ਤੁਸੀਂ ਟਾਈਪ ਕਰਕੇ ਜਾਂ ਬੋਲ ਕੇ ਨਹੀਂ ਕਰ ਸਕਦੇ ਲਿਖਣ ਔਰ ਬੋਲਣਾ ਦੋਵੇਂ ਵੱਖ ਵੱਖ ਸਕਿਲ ਨੇ ਲਿਖਣਾ ਜਿਹੜਾ ਹੈ ਉਹ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਜੋ ਤੁਸੀਂ ਇੱਕ ਵਾਰ ਲਿਖ ਲੈਂਦੇ ਹੋ